ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬ ਲੋਕ ਸਮੂਹ ਦੁਆਰਾ ਸਜੀ ਵਿਸ਼ੇਸ਼ ਜੀਵਨ ਜਾਤ ਜਿਸ ਵਿੱਚ ਉਹਨਾਂ ਦੇ ਲੋਕਾਂ ਦਾ ਰਹਿਣ ਸਹਿਣ ਕਿੱਤੇ ਰਸਮ ਰਿਵਾਜ ਰਿਸ਼ਤੇ ਨਾਤੇ ਪਹਿਰਾਵਾ ਵਿਸ਼ਵਾਸ ਕੀਮਤਾਂ ਮਨੋਰੰਜਨ ਦੇ ਸਾਧਨ ਭਾਸ਼ਾ ਅਤੇ ਲੋਕ ਸਹਿਤ ਸ਼ਾਮਿਲ ਹੁੰਦੇ ਹਨ ਪੰਜਾਬੀ ਸੱਭਿਆਚਾਰ ਪੁਰਾਣਾ ਅਤੇ ਅਮੀਰ ਵਿਰਸਾ ਹੈ ਪੰਜਾਬੀ ਸੱਭਿਆਚਾਰ ਦੀ ਵਿਸ਼ੇਸ਼ ਭੂਗੋਲਿਕ ਸਥਿਤੀ ਨਵੇਕਲੇ ਵਾਯੂਕਰਣ ਅਤੇ ਇਤਿਹਾਸਿਕ ਉਤਸ਼ਾਵਾਂ ਚੜਾਵਾਂ ਅਤੇ ਪੰਜਾਬੀ ਜੀਵਨ ਜਾਂਚ ਦੇ ਕੋਈ ਕਈ ਅਜਿਹੇ ਦਿਲਚਸਪ ਦੇ ਸ਼ਕਤੀਸ਼ਾਲੀ ਪੱਖ ਉਸਰੇ ਹਨ ਜੋ ਪੰਜਾਬੀ ਅਤੇ ਦੇ ਪਛਾਣ ਚਿੰਨ੍ਹ ਬਣ ਗਏ ਹਨ ਇਹਨਾਂ ਵਿਲੱਖਣ ਭਾਸ਼ਾਵਾਂ ਚਿੰਨ੍ਹ ਕਰਕੇ ਪੰਜਾਬੀ ਸੱਭਿਆਚਾਰ ਦੂਜੇ ਦੇਸ਼ਾਂ ਜਿਵੇਂ ਪਾਕਿਸਤਾਨ ਕਨੇਡਾ ਅਮੈਰੀਕਾ ਇੰਗਲੈਂਡ ਸ਼੍ਰੀਲੰਕਾ ਬੰਗਲਾਦੇਸ਼ ਨਿਊਜ਼ੀਲੈਂਡ ਆਦਿ 'ਤੇ ਸੱਭਿਆਚਾਰ ਵਿੱਚ ਅੰਤਰ ਨਜ਼ਰੀ ਆਉਂਦਾ ਹੈ ਪੰਜਾਬੀ ਲੋਕ ਖੁੱਲਾ ਖਾਣ ਪੀਣ ਦੇ ਸ਼ੌਕੀਨ ਹਨ ਦੁੱਧ ਦਹੀਂ ਲੱਸੀ ਮੱਖਣ ਘਿਓ ਮੂਲੀ ਆਲੂ ਦੇ ਪਰਾਂਠੇ ਗੋਭੀ ਦੇ ਪਰਾਂਠੇ ਆਦਿ ਪਸੰਦ ਕਰਦੇ ਹਨ ਕਿ ਦੂਜੇ ਦੇਸ਼ਾਂ ਵਿੱਚ ਬਰੈੱਡ ਪਾਸਤਾ ਬਰਗਰ ਮੋਮੋਜ਼ ਨੂਡਲ ਪਸੰਦ ਕੀਤੇ ਜਾਂਦੇ ਹਨ ਪੰਜਾਬੀ ਸਿਹਤ ਪੱਖੋਂ ਵੀ ਤਕੜੇ ਹਨ ਚੰਗਾ ਖਾਣ ਪੀਣ ਕਰਕੇ ਸਿਹਤਮੰਦ ਅਤੇ ਤਾਕਤਵਰ ਹੁੰਦੇ ਹਨ ਇਹ ਸਾਰੇ ਹੱਥੀਂ ਕੰਮ ਕਰਦੇ ਹਨ ਜਦੋਂ ਕਿ ਦੂਜੇ ਦੇਸ਼ਾਂ ਵਿੱਚ ਨਵੀਂ ਟੈਕਨੋਲੋਜੀ ਦੀਆਂ ਮਸ਼ੀਨਾਂ ਨਾਲ ਕੰਮ ਕੀਤਾ ਜਾਂਦਾ ਹੈ